ਸੋਸ਼ਲ ਮੀਡੀਆ ਦੇ ਕੁਝ ਖਾਤੇ ਹਨ ਜਿਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ ਜਿਹਨਾਂ ਵਿੱਚੋਂ ਕੁਝ ਖ ਖਾਤੇ ਹਨ ਆਪਣੀ ਅਸਲ ਤਸਵੀਰ ਦਾ ਉਪਯੋਗ ਕਰੋ ਅਤੇ ਇਹ ਸਵੀਕਾਰ ਕਰਨਾ ਕਿ ਤੁਸੀਂ ਜੋ ਕਰਦੇ ਹੋ ਉਹ ਹਰ ਕੋਈ ਦੇਖ ਸਕਦਾ ਹੈ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਕਿਉਂਕਿ ਆਖਦੇ ਹਨ ਗੁਣਵੱਤਾ ਤੋਂ ਮਾਤਰਾ ਵਧੇਰੇ ਬਿਹਤਰ ਹੈ ਇਸ ਲਈ ਫਾਲਤੂ ਸਮੱਗਰੀ ਦੀ ਜਗ੍ਹਾ ਕੇਵਲ ਉਪਯੋਗਸ਼ੀਲ ਪੋਸਟ 'ਤੇ ਧਿਆਨ ਦੇਵੋ ਸ਼ੁੱਧ ਵਿਆਕਰਨ ਦੇ ਸ਼ਬਦਾਂ ਦੀ ਵਰਤੋਂ ਕਰੋ ਕਿਉਂਕਿ ਕੁਝ ਮਿਸ਼ਰਤ ਅਤੇ ਗੁੰਝਲਦਾਰ ਸ਼ਬਦ ਤੁਹਾਡੇ ਸੰਦੇਸ਼ ਨੂੰ ਗੁੰਝਲਦਾਰ ਅਤੇ ਕਠਿਨ ਬਣਾ ਸਕਦੇ ਹਨ ਇੱਜ਼ਤ ਅਤੇ ਸਨਮਾਨ ਵਾਲੀ ਭਾਸ਼ਾ ਦਾ ਪ੍ਰਯੋਗ ਕਰੋ ਕਿਉਂਕਿ ਜੇਕਰ ਤੁਸੀਂ ਕਿਸੇ ਨੂੰ ਜਿੰਨੀ ਇੱਜਤ ਅਤੇ ਸਨਮਾਨ ਦਿੰਦੇ ਹੋ ਬਦਲੇ ਵਿੱਚ ਤੁਹਾਨੂੰ ਉਨਾਂ ਅਤੇ ਉਸ ਤੋਂ ਜ਼ਿਆਦਾ ਵੀ ਪ੍ਰਾਪਤ ਹੁੰਦਾ ਹੈ ਕਿਸੇ ਵੀ ਅਣਜਾਣ ਵਿਅਕਤੀ ਨਾਲ ਗੱਲਬਾਤ ਨਾ ਕਰੋ ਅਤੇ ਉਹਨਾਂ ਨਾਲ ਆਪਣੇ ਕੋਈ ਵੀ ਪਰਸਨਲ ਇਨਫੋਰਮੇਸ਼ਨ ਸਾਂਝੀ ਨਾ ਕਰੋ ਜਿ ਜਿਸ ਵਿੱਚ ਤੁਹਾਡਾ ਨਾਮ ਪਤਾ ਕੋਂਟੈਕਟ ਨੰਬਰ ਕੋਈ ਬੈਂਕ ਡਿਟੇਲ ਆਦਿ ਸ਼ਾਮਿਲ ਹਨ ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਸਪੈਮ ਕੋਲਰਸ ਤੁਹਾਨੂੰ ਤੰਗ ਕਰਦੇ ਹਨ ਜੋ ਕਿ ਤੁਹਾਡੀ ਸੂਚਨਾ ਦੀਆਂ ਗਲਤ ਉਪਯੋਗ ਕਰਕੇ ਫਰੋਡ ਕਰਦੇ ਹਨ ਇੱਕ ਸ਼ਡਿਊਲ ਸੈੱਟ ਕਰੋ ਅਤੇ ਉਸਦੇ ਹਿਸਾਬ ਨਾਲ ਆਪਣੀਆਂ ਪੋਸਟ ਸਾਂਝੀਆਂ ਕਰੋ ਜਿਸ ਨਾਲ ਤੁਹਾਡੇ ਫੋਲੋਅਰਸ ਨੂੰ ਵੀ ਕੋਈ ਦਿੱਕਤ ਨਹੀਂ ਆਵੇਗੀ ਅਤੇ ਤੁਹਾਨੂੰ ਵੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸੋਸ਼ਲ ਮੀਡੀਆ ਦੇ ਕੁਝ ਖਾਤੇ ਯੂਜ਼ਰਸ ਦੇ ਬਿਹਾਰ ਅਤੇ ਸਮੱਗਰੀ ਨੂੰ ਨਿਯੰਤਰਨ ਕਰਨ ਲਈ ਸੋਸ਼ਲ ਮੀਡੀਆ ਪਲੇਟਫੋਮ ਦੁਆਰਾ ਨਿਰਧਾਰਿਤ ਦਿਸ਼ਾ ਨਿਰਦੇਸ਼ ਹੁੰਦੇ ਹਨ ਜਿਹਨਾਂ ਨੂੰ ਮੰਨਣਾ ਜ਼ਰੂਰੀ ਹੁੰਦਾ ਹੈ ਇਹ ਅਸੀਂ ਸਵੀਕਾਰ ਕਰ ਸਕਦੇ ਕਰਦੇ ਹਾਂ ਤਾਂ ਜੋ ਅਸੀਂ ਆਪਣਾ ਸੋਸ਼ਲ ਮੀਡੀਆ 'ਤੇ ਅਕਾਊਂਟ ਅਤੇ ਉਸ ਐਪ ਨੂੰ ਵਰਤ ਸਕੀਏ ਧੰਨਵਾਦ